ਹਾਂ ਜੀ ਸਰ ਪਰਦੀਪ ਸਿੰਘ ਬੋਲ ਰਿਹਾਂ ਮੈਂ ਰੋਪੜ ਤੋਂ ਤੁਸੀਂ ਕੈਬ ਬੁੱਕ ਕਰੀ ਸੀਗੀ ਅਸੀਂ ਜਾਣਾ ਤਾਂ ਰੋਪੜ ਤੋਂ ਸ਼ਿਮਲੇ ਅਤੇ ਕੈਬ ਵੀ ਅਸੀਂ ਦੋ ਦਿਨ ਪਹਿਲਾਂ ਬੁੱਕ ਕਰਤੀ ਸੀ ਅਤੇ ਡਰੈਵਰ ਨੂੰ ਅਸੀਂ ਸਵੇਰ ਦੇ ਕੋਲ ਕਰ ਰਹੇ ਆ ਉਹ ਕੋਲ ਏ ਚੱਕ ਨਹੀਂ ਰਿਹਾ ਤਾਂ ਹੁਣ ਐਟ ਏ ਟਾਇਮ ਸਾਨੂੰ ਕੋਈ ਹੋਰ ਕੈਬ ਵੀ ਨਹੀਂ ਮਿਲ ਰਹੀ ਤੁਸੀਂ ਮੇਰੀ ਸ਼ਿਕਾਇਤ ਨੋਟ ਕਰ ਲਓ ਵੀ ਅੱਗੇ ਤੋਂ ਕਿਸੇ ਨੂੰ ਇੱਦਾਂ ਦੀ ਸਮੱਸਿਆ ਨਾ ਆਵੇ ਕਿਉਂਕਿ ਹੁਣ ਘੁੰਮ ਘੁੰਮਣ ਫਿਰਨ ਦਾ ਸੀਜ਼ਨ ਆ ਫਿਰ ਕੋਈ ਕੈਬ ਵੀ ਨਹੀਂ ਮਿਲਦੀ ਹੈਗੀ ਐਟ ਏ ਟਾਇਮ ਤਾਂ ਤੁਸੀ ਮੇਰੀ ਸ਼ਿਕਾਇਤ ਨੋਟ ਕਰ ਲਓ ਵੀ ਅੱਗੇ ਤੋਂ ਕਿਸੇ ਨੂੰ ਇੱਦਾਂ ਦੀ ਸਮੱਸਿਆ ਨਾ ਆਵੇ